ਹੈਲੋ ਹਾਂਜੀ ਭਾਅ ਜੀ ਹੈਲੋ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਹੁਣ ਅੱਜ ਦੀ ਡੇਟ 'ਚ ਬਹੁਤ ਹੀ ਜ਼ਿਆਦਾ ਡਿਫਰੈਂਸ ਆ ਚੁੱਕਾ ਪਹਿਲੇ ਤੁਸੀਂ ਦੇਖੋ ਕਿ ਪੰਜਾਬੀ ਸਿਨੇਮਾ ਜਿਆਦਾਤਰ ਛੋਟੇ ਪਰਦੇ ਚੋ ਛੋਟੀ ਬਣਦੀਆਂ ਸੀਗੀਆਂ ਉਹਨਾਂ ਦਾਇਰਾ ਵੀ ਬੜਾ ਛੋਟਾ ਸੀਗਾ ਅਤੇ ਜੋ ਕਲਾਕਾਰ ਸੀਗੇ ਉਹਨਾਂ ਨੂੰ ਵੀ ਮਤਲਬ ਇੰਨੀ ਸਹੂਲਤਾਂ ਨਹੀਂ ਮਿਲਦੀਆਂ ਸੀਗੀਆਂ ਜਿੰਨੇ ਕਿ ਅੱਜ ਡੇਟ 'ਚ ਮਿਲਦੀ ਹੈ ਅੱਜ ਅੱਜ ਸਾਰਾ ਕੁਝ ਹੀ ਬਹੁਤ ਕੁਝ ਵੱਧ ਗਿਆ ਹੋਇਆ ਅੱਜ ਆਰਾਮ ਨਾਲ ਪਿਕਚਰੈਜਸਾਂ ਕਰਨ ਲਈ ਲੋਕ ਇਹਨਾਂ ਦੇ ਬਜਟ ਵੱਧ ਗਏ ਨੇ ਚੰਗੀ ਫਿਲਮਾਂ ਹਾਸਲ ਪੰਜਾਬ ਬਹੁਤ ਵਾਧੂ ਹੋ ਗਏ ਆ ਅੱਛੇ ਅੱਛੇ ਇਕੱਲਾ ਘਰ ਨੇ ਯੰਗ ਮੁੰਡੇ ਜਾਂ ਕੁੜੀਆਂ ਮਤਲਬ ਚੰਗੀ ਤਰ੍ਹਾਂ ਅੱਗੇ ਉਭਰ ਕੇ ਆਏ ਆ ਜਿਨਾਂ ਦੀ ਮਤਲਬ ਬਹੁਤ ਅੱਛੀ ਐਕਟਿੰਗ ਹੁੰਦੀ ਹੈ ਤੇ ਉਹ ਵੀ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਵੀ ਉੱਚੇ ਇੰਕਲੂਡ ਕਾਫੀ ਕਰ ਲਿਆ ਇਹਨਾਂ ਨੇ ਬਜਟ ਸਭ ਤੋਂ ਵੱਡਾ ਮੇਨ ਕਾਰਨ ਹੁੰਦਾ ਬਜਟ ਹੋਣ ਕਰਕੇ ਸਾਰਾ ਕੁਝ ਅਲੱਗ ਅਲਗ ਥਾਵਾਂ ਤੇ ਜਾ ਕੇ ਅਲੱਗ ਅਲੱਗ ਪ੍ਰੋਗਰਾਮ ਮਤਲਬ ਸ਼ਹਿਰਾਂ ਚ ਜਾ ਕੇ ਵੀ ਪਿਕਚਰਾਈਜੇਸ਼ਨ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਜਿਆਦਾ ਇਸ ਕਰਕੇ ਭਾਅ ਜੀ ਆਹ ਡਿਫਰੈਂਸ ਬਹੁਤ ਹੈ ਪਹਿਲੇ ਕਲਾਕਾਰਾਂ ਨੂੰ ਇੱਕ ਕਮਰੇ 'ਚ ਵੀ ਇੱਕ ਏਰੀਏ ਚ ਵੀ ਕਰ ਲੈਂਦੇ ਸੀ ਹੁਣ ਜਿੱਥੇ ਮਰਜ਼ੀ ਚੱਕ ਕੇ ਕਰ ਲਓ ਬਜਟ ਦਾ ਬੜਾ ਰੋਲ ਹੈ ਆਹੀ ਫੈਸਲਿਟੀਆਂ ਅੱਜ ਜਿਸ ਚ ਬਹੁਤ ਕੁਝ ਹੈ ਤੇ ਨਾਲ ਉਹਨੂੰ ਇਹਦਾ ਨਾ ਆਹ ਵੀ ਫਰਕ ਹੋਇਆ ਕਿ ਅੱਜ ਕਾ ਪੰਜਾਬ ਦੇ ਜਿੰਨੇ ਵੀ ਕਲਾਕਾਰ ਐ ਉਹਨੂੰ ਸਾਰੇ ਕਰਨ ਕਰ ਸਕਦੇ ਹੈ ਤੇ ਉਹਨਾਂ ਦਾ ਫਿਆਦਾ ਵੀ ਉਹਨਾਂ ਨੂੰ ਬਹੁਤ ਹੁੰਦਾ ਪੰਜਾਬ 'ਚ ਆ ਕੇ ਸ਼ੂਟਿੰਗ ਆ ਪੰਜਾਬ ਦੇ ਕਲਚਰ ਤੇ ਤੋ ਮਸ਼ਹੂਰ ਹੈ ਹੀ ਹੈ ਜ ਸੁਚੇ ਚਲਦੀਆਂ ਇਸ ਕਰਕੇ ਭਾਅ ਜੀ ਆਹ ਫਰਕ ਪੈ ਗਿਆ ਬਹੁਤ ਦੋਨਾਂ ਚ ਡੈਫਰੈਂਸ ਹੋ ਗਿਆ ਜੀ ਹਾਂਜੀ ਹਾਂਜੀ ਤੇ ਹੋਰ ਭਾਅ ਜੀ ਤੁਸੀਂ ਮਤਲਬ ਕਿਧਰੋਂ ਬੋਲਦੇ ਪਏ ਹੋ

ਹਾਂ ਅਸੀਂ ਪ੍ਰੋਡਕਸ਼ਨ ਦੇ ਸਾਰਾ ਕੰਮ ਕਰਦੇ ਆਂ ਦੇਖਦੇ ਕਰਦੇ ਆਂ ਸਾਰਾ ਕੁਝ ਤੇ ਕਰਕੇ ਸਾਨੂੰ ਕੁਛ ਸਾਰਾ ਕੁਝ ਕਰ ਲਓ ਇੱਕੋ ਜਗ੍ਹਾ ਤੇ ਇੱਕੋ ਜਗ੍ਹਾ ਤੇ ਹੀ ਸਾਰਾ ਕੁਝ ਮਿਲ ਜਾਂਦਾ ਹੈ ਪਹਿਲੇ ਚੀਜ਼ਾਂ ਨੂੰ ਇਕੱਠੀਆਂ ਕਰਨਾ ਹੀ ਬੜਾ ਔਖਾ ਹੁੰਦਾ ਸੀਗਾ ਭਾਅ ਜੀ ਠੀਕ ਹੈ ਨਾ ਕੋਈ ਮੰਦਾ ਨਹੀਂ ਤਾਣੀ ਆਸਾਨ ਹੁੰਦੀ ਨਹੀਂ ਸੀਗੀ ਮੇਰਾ ਮਤਲਬ ਅੱਜ ਤਕਨੀਕਾ ਇਹਨਾਂ ਦੀ ਆ ਗਈ ਹੈ ਕਿ ਬਸ ਪੰਜਾਬੀ ਫਿਲਮਾਂ ਬਹੁਤ ਸੋਹਣੀ ਬੋਲਣੀ ਵਧੀਆ ਬਣਨ ਲੱਗ ਗਈ ਹੈ ਠੀਕ ਹੈ ਭਾਅ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ